ਪੰਜਾਬ ਵਿੱਚ ਬੈਂਕਿੰਗ ਅਤੇ ਬੀਮਾ ਦੇ ਸੰਬੰਧ ਕੁਝ ਮੁੱਖ ਚੁਣੌਤੀਆਂ ਤੇ ਹੁੰਦੇ ਹਨ ਪੰਜਾਬ ਇੱਕ ਅਮੀਰ ਪ੍ਰਦੇਸ਼ ਆ ਜਿਸ ਵਿੱਚ ਲੋਕਾਂ ਨੂੰ ਥੋੜਾ ਜਿਹਾ ਆਰਥਿਕ ਸਿੱਖਿਆ ਦੀ ਘਾਟ ਹੈ ਨਿਯਮਾਂ ਦਾ ਪਾਲਣਾ ਦੀ ਘਾਟ ਹੈ ਧੋਖੇਦੜੀ ਤੋਂ ਡਰਦੇ ਨੇ ਲੰਬੇ ਸਮੇਂ ਤੱਕ ਸਥਿਰਤਾ ਨਹੀਂ ਹੈ ਆਰਥਿਕ ਸਿੱਖਿਆ ਦੀ ਘਾਟ ਪੰਜਾਬ ਵਿੱਚ ਲੋਕਾਂ ਦੀਆਂ ਸਿੱਖਿਆ ਦੀ ਘਾਟ ਹੈ ਜਿਸ ਨਾਲ ਬੈਂਕਿੰਗ ਅਤੇ ਬੀਮਾ ਉਤਪਾਦਕ ਉਤਪਾਦਾਂ ਦੀ ਸਮਝ ਅਤੇ ਉਹਨਾਂ ਦੀ ਵਰਤੋਂ ਘੱਟ ਹੈ ਘੱਟ ਹੈ ਨਿਯਮਾਂ ਦੀ ਪਾਲਣਾ ਬੈਂਕ ਅਤੇ ਬੀਮਾ ਕੰਪਨੀਆਂ ਨੂੰ ਸਿੱਖਤ ਯੋਜਨਾ ਯੋਜਨਾ ਅਤੇ ਵਿੱਦਿਆ ਦੀ ਪਾਲਣਾ ਕਰਨੀ ਪੈਂਦੀ ਹੈ ਇਸ ਵਿੱਚ ਪੰਜਾਬ ਦੇ ਲੋਕਾਂ ਨੂੰ ਥੋੜੀ ਜਿਹੀ ਤੇ ਜੁਰਮਾਨੇ ਤੇ ਕਾਨੂੰਨੀ ਮੁੱਦੇ ਹੋ ਸਕਦੇ ਹਨ ਜੋ ਕਿ ਜਿਸ ਦੀ ਪਾਲਣਾ ਤੋ ਉਹ ਡਰਦੇ ਧੋਖਾਧੜੀ ਜਿਆਦਾ ਹੁੰਦੀ ਹੈ ਡਿਜੀਟਲ ਬੈਂਕਿੰਗ ਅਤੇ ਇਨਸ਼ੋਰੈਂਸ ਉਤਪਾਦਕ ਵੱਧ ਰਹੇ ਹਨ ਜਿਸ ਦੀ ਧੋਖਾਧੜੀ ਅਤੇ ਵਿੱਤ ਕਪਟ ਦਾ ਖਤਰਾ ਵੱਧ ਖਤਰਾ ਵੱਧ ਗਿਆ ਹੈ ਬੈਂਕ ਦੇ ਬੀਮਾ ਕੰਪਨੀਆਂ ਨੂੰ ਆਪਣੀ ਸਾਈਬਰ ਸੁਰੱਖਿਆ ਦੀ ਮਜਬੂਤ ਕਰਨੀ ਪੈਂਦੀ ਹੈ ਲੰਬੇ ਸਮੇਂ ਤੱਕ ਸਥਿਰਤਾ ਬੈਂਕਿੰਗ ਅਤੇ ਬੀਮਾ ਉਪਯੋਗ ਵਿੱਚ ਮੁਸ਼ਕਿਲਾਂ ਦੂਰ ਕਰਨ ਲਈ ਜਰੂਰੀ ਹੈ ਕਿ ਖੇਤਰ ਬਦਲਿਆ ਵਿੱਤ ਆਰਥਿਕ ਹਾਲਾਤਾਂ ਨੂੰ ਨਾਲ ਖੁਦ ਨੂੰ ਅਪਡੇਟ ਅਤੇ ਢਾਲ ਸਕੇ ਢਾਲ ਸਕੇ ਆਮ ਜਨਤਾ ਖਾਸ ਤੌਰ ਤੇ ਦਿਹਾਤੀ ਖੇਤਰਾਂ ਵਿੱਚ ਬੈਂਕੀਆਂ ਤੇ ਬੀਮਾ ਸੇਵਾ ਦਾ ਪਹੁੰਚ ਘੱਟ ਹੋਇਆ ਹੈ ਬੀਮਾ ਬਿਨਾਂ ਸਹੀ ਜਗ੍ਹਾ ਅਤੇ ਸਮੱਗਰੀ ਦੀ ਉਪਲੱਬਧਤਾ ਦੇ ਲੋਕ ਉਹ ਸੇਵਾ ਨਹੀਂ ਪਾਉਂਦੇ ਜਿਨਾਂ ਨੂੰ ਉਹਨਾਂ ਨੂੰ ਜਰੂਰਤ ਹੈ ਹੈਲਥ ਦੇ ਖੇਤਰ ਦੇ ਵਿੱਚ ਪੰਜਾਬ ਦੇ ਹੈਲਥ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ